ਮੈਂ ਮਾਨਵ ਪਠਾਣੀਆ ਪਠਾਣਕੋਟ ਦਾ ਰਹਿਣ ਵਾਲਾ ਹਾਂ ਜਿੱਦਾਂ ਕਿ ਪੰਜ ਨੰਬਰ ਦਸ ਤੋਂ ਦਸ ਲੱਖ ਤੱਕ ਮੈਨੂੰ ਚੇਤਾ ਹੈ ਉਹ ਇਸ ਪ੍ਰਕਾਰ ਹਨ ਪਹਿਲਾ ਪੰਜਾਹ ਦੂਜਾ ਸੱਠ ਤੀਜਾ ਸੌ ਚੌਥਾ ਹਜ਼ਾਰ ਅਤੇ ਆਖਰੀ ਜੋ ਕਿ ਪੰਜਵਾਂ ਹੈ ਉਹ ਹੈ ਪੰਜ ਸੌ